ਭੰਗੜਾ ਕਰਨ ਸਮੇਂ ਕੁਰਤਾ ਚਾਦਰਾ ਪਹਿਨਿਆ ਜਾਂਦਾ ਹੈ ਜੋ ਕਿ ਪੰਜਾਬ ਦੀ ਬਹੁਤ ਪੁਰਾਣੀ ਵਿਰਾਸਤ ਇਸ ਪੋਸ਼ਾਕ ਵਿੱਚ ਸ਼ਾਮਿਲ ਹੈ ਜੋ ਕੀ ਪੁਰਾਣੇ ਲੋਕ ਇਸ ਨੂੰ ਬਹੁਤ ਹੀ ਸ਼ੌਂਕ ਨਾਲ ਪਹਿਨਦੇ ਸਨ ਅਤੇ ਅੱਜ ਕੱਲ ਇਹ ਭੰਗੜੇ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਕੁੜਤਾ ਸਰੀਰ ਦੇ ਉਪਰਲੇ ਹਿੱਸੇ ਉੱਪਰ ਪਹਿਨਿਆ ਜਾਂਦਾ ਹੈ ਅਤੇ ਚਾਦਰਾ ਸਰੀਰ ਦੇ ਹੇਠਲੇ ਹਿੱਸੇ ਵਿੱਚ ਬੰਨਿਆ ਜਾਂਦਾ ਹੈ ਜੋ ਕਿ ਇੱਕ ਚਾਦਰ ਦੇ ਵਾਂਗ ਕੱਪੜਾ ਹੁੰਦਾ ਹੈ ਜਿਸ ਨੂੰ ਚਾਦਰਾ ਕਹਿੰਦੇ ਹਨ ਅਤੇ ਕੁੜਤੇ ਦੇ ਉੱਪਰ ਇੱਕ ਛੋਟੀ ਜਿਹੀ ਕੁੜਤੀ ਪਹਿਨੀ ਜਾਂਦੀ ਹੈ ਜੋ ਕਿ ਰੰਗ ਬਰੰਗੀ ਹੁੰਦੀ ਹੈ ਜੋ ਕਿ ਵੇਖਣ ਨੂੰ ਕਾਫੀ ਵਧੀਆ ਜਾ ਸੋਹਣੀ ਲੱਗਦੀ ਹੈ ਅਤੇ ਸਿਰ ਤੇ ਇੱਕ ਪੱਗ ਬੰਨੀ ਜਾਂਦੀ ਹੈ ਜੋ ਕਿ ਸਰਗਿਆਂ ਵਾਲੀ ਪੱਗ ਹੁੰਦੀ ਹੈ ਜੋ ਕਿ ਦੇਖਣ ਨੂੰ ਕਾਫੀ ਸੋਹਣੀ ਲੱਗਦੀ ਹੈ ਅਤੇ ਸਾਰੇ ਭੰਗੜਾ ਕਰਨ ਵਾਲੇ ਇਹ ਰੰਗ ਬਦਲ ਬਦਲ ਕੇ ਪੱਗਾਂ ਅਤੇ ਕੁੜਤੀ ਪਹਿਨਦੇ ਹਨ ਜੋ ਕਿ ਵੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ